ਹੈਲੋ ਹਾਂਜੀ ਹਾਂਜੀ ਬੋਲੋ ਅੱਛਾ ਕਿੰਨੇ ਬੰਦੇ ਹੋਣਗੇ ਅੱਛਾ ਮਤਲਬ ਅੱਸੀ ਨੱਬੇ ਨੱਬੇ ਸੌ ਦੇ ਵਿੱਚ ਵਿੱਚ ਹੋ ਜਾਣਗੇ ਅਤੇ ਤੁਸੀਂ ਟਾਈਮਿੰਗ ਕਿੰਨੀ ਰੱਖਣੀ ਹੈ ਛੇ ਵਜੇ ਕਿੰਨੇ ਘੰਟੇ ਛੇ ਤੋਂ ਦਸ ਠੀਕ ਹੈ ਅਤੇ ਮੈਨਿਊ 'ਚ ਕੀ ਕੀ ਚਾਹੀਦਾ ਤੁਹਾਨੂੰ ਹਾਂਜੀ ਹਾਂਜੀ ਔਰ ਹਾਂਜੀ ਔਰ ਓਕੇ ਸਰ ਹੋ ਜਾਵੇਗਾ ਓਕੇ ਓਕੇ ਸਰ ਅਤੇ ਉਹ ਓਕੇ ਸਰ ਅਤੇ ਕੋਪਲੀਮੈਂਟਰੀ ਨਾ ਬਸ ਅਸੀਂ ਨਾ ਪਾਣੀ ਦੀ ਬੋਟਲ ਦੇ ਸਕਦੇ ਹਾਂ ਅਤੇ ਨਾਲ ਇੱਕ ਜਾਂ ਆਈਸਕਰੀਮ ਦਾ ਸਟੋਲ ਦੇ ਸਕਦੇ ਹਾਂ ਉਹ ਸਲੈਕਟ ਤੁਸੀਂ ਕਰਨਾ ਦੋ ਮਿੰਟ ਫਿਰ ਡੈਕੋਰੇਸ਼ਨ ਦਾ ਲਾ ਲਓ ਡੈਕੋਰੇਸ਼ਨ ਦੇ ਵਿੱਚ ਸਟੇਜ ਵਗੈਰਾ ਤੇ ਹੋਲ ਹੋਲ ਬੁੱਕ ਕਰਕੇ ਸਟੇਜ 'ਤੇ ਜਿਵੇਂ ਮਾਈਅਕ ਲੱਗ ਜਾਵੇਗਾ ਅਤੇ ਡੀਜੇ ਵਗੈਰਾ ਬੁੱਕ ਕਰਕੇ ਨਾ ਐਸਟੀਮੇਟ ਲਗਾ ਲਓ ਪ੍ਰਾਈਜ਼ ਪੰਜਾਹ ਸੱਠ ਹਜ਼ਾਰ ਦੇ ਵਿੱਚ ਵਿੱਚ ਹੋ ਜਾਵੇਗਾ ਅਤੇ ਆਪਾਂ ਨਾ ਬਾਕੀ ਗੱਲ ਨਾ ਮੀਟਿੰਗ ਬਹਿ ਬੂ ਕੇ ਕਰ ਲੈਂਦੇ ਹਾਂ ਉਹ ਨਾ ਆਪਾਂ ਗੱਲ ਨਾ ਬਹਿ ਕੇ ਕਰ ਲਾਂਗੇ ਅੱਜ ਸ਼ਾਮੀ ਮਿਲ ਲਿਓ ਤੁਸੀਂ ਮੈਨੂੰ ਹਾਂਜੀ ਥੈਂਕ ਯੂ ਸਰ